ਮੈਨੂੰ ਪੌਦੇ ਲਗਾਉਣ ਦਾ ਬਹੁਤ ਸ਼ੌਂਕ ਹੈ ਮੈਂ ਘਰ ਵਿੱਚ ਹੀ ਇੱਕ ਛੋਟੀ ਜਿਹੀ ਕਿਆਰੀ ਤਿਆਰ ਕੀਤੀ ਹੈ ਉਸ ਵਿੱਚ ਮੈਂ ਤਰ੍ਹਾਂ ਤਰ੍ਹਾਂ ਦੇ ਫੁੱਲ ਲਗਾਏ ਹੋਏ ਹਨ ਉਸ ਵਿੱਚ ਮੈਂ ਮੌਸਮੀ ਫੁੱਲ ਵੀ ਲਗਾਏ ਹੋਏ ਹਨ ਉਸ ਵਿੱਚ ਮੈਂ ਸਦਾਬਹਾਰ ਪੌਦੇ ਵੀ ਲਗਾਏ ਹੋਏ ਹਨ ਇਹਨਾਂ ਦੀ ਸਾਂਭ ਸੰਭਾਲ ਨੂੰ ਮੈਂ ਬਹੁਤ ਲਾਊਡਲੀ ਲੈਂਦੀ ਹਾਂ ਮੈਂ ਪੌਦਿਆਂ ਨੂੰ ਚੰਗੀ ਤਰ੍ਹਾਂ ਪਾਣੀ ਦਿੰਦੀ ਹਾਂ ਉਹਨਾਂ ਨੂੰ ਦਵਾਈ ਖਾਦ ਸਪਰੇ ਸਭ ਕੁਛ ਕਰਦੀ ਹਾਂ ਜਿਸ ਤਰ੍ਹਾਂ ਬਰਸਾਤ ਦੇ ਮੌਸਮ ਵਿੱਚ ਉਹਨਾਂ ਨੂੰ ਉੱਲੀ ਲੱਗ ਜਾਂਦੀ ਉਹਨਾਂ ਨੂੰ ਮੈਂ ਫੰਗੀ ਸਾਈਡ ਸਾਫ਼ ਅਤੇ ਕੀਟਨਾਸ਼ਕ ਹੋਰ ਦਵਾਈਆਂ ਪਾਉਂਦੀ ਹਾਂ ਜਿਸ ਤਰ੍ਹਾਂ ਹੁਣ ਬੂਟਿਆਂ ਉੱਪਰ ਬੂਰ ਪੈਂਦਾ ਹੈ ਅਤੇ ਉਸਨੂੰ ਤੇਲਾ ਪੈ ਜਾਂਦਾ ਉਸਨੂੰ ਮੈਂ ਤੇਲਾ ਰਹਿਤ ਦਵਾਈ ਦੀ ਸਪਰੇ ਕਰਦੀ ਹਾਂ ਇਸ ਤਰ੍ਹਾਂ ਮੈਂ ਕਈ ਤਰ੍ਹਾਂ ਦੀਆਂ ਹੋਰ ਵੀ ਦਵਾਈਆਂ ਪਾਉਂਦੀ ਹਾਂ ਜਿਸ ਤਰ੍ਹਾਂ ਗੁਲਾਬ ਦੇ ਚੰਗੇ ਫੁੱਲ ਲੈਣ ਵਾਸਤੇ ਉਸ ਵਿੱਚ ਮੈਂ ਔਰਗੈਨਿਕ ਖਾਦ ਘਰ ਵਿੱਚ ਹੀ ਤਿਆਰ ਕਰਕੇ ਪਾਉਂਦੀ ਹਾਂ ਇਸ ਤਰ੍ਹਾਂ ਕਈ ਹੋਰ ਤਰ੍ਹਾਂ ਦੀਆਂ ਦਵਾਈਆਂ ਹਨ ਜਿਵੇਂ ਸਾਫ਼ ਔਰਗੈਨਿਕ ਖਾਦ ਅਤੇ ਕਈ ਹੋਰ ਪ੍ਰਕਾਰ ਦੀਆਂ ਦਵਾਈਆਂ ਹਨ ਉਹਨਾਂ ਨੂੰ ਮੈਂ ਸਮੇਂ ਸਮੇਂ 'ਤੇ ਆਪਣੇ ਬੂਟਿਆਂ ਵਿੱਚ ਪਾ ਕੇ ਆਪਣੇ ਬੂਟਿਆਂ ਨੂੰ ਹਰਾ ਭਰਾ ਕਰਦੀ ਹਾਂ ਅਤੇ ਆਪਣੇ ਕਿਆਰੀ ਨੂੰ ਬੜੇ ਧਿਆਨ ਨਾਲ ਤਿਆਰ ਕਰਦੀ ਹਾਂ ਅਤੇ ਮੇਰੇ ਇਸ ਤਰ੍ਹਾਂ ਮੇਰੀ ਕਿਆਰੀ ਬਹੁਤ ਹੀ ਸੋਹਣੀ ਫੁੱਲਾਂ ਨਾਲ ਸੱਜ ਕੇ ਤਿਆਰ ਹੋ ਜਾਂਦੀ ਹੈ